ਹੈਲੋ ਹਾਂਜੀ ਸਰ ਮੈਂ ਆ ਰਿਹਾ ਸੀਗਾ ਥੋੜ੍ਹਾ ਟਰੈਫਿਕ ਕਰਕੇ ਥੋੜ੍ਹਾ ਇਸ਼ੂ ਜਿਹਾ ਪੈ ਰਿਹਾ ਸੀਗਾ ਮੈਂ ਰੂਟ ਚੇਂਜ ਕੀਤੇ ਦੋ ਤਿੰਨ ਵਾਰੀ ਸਰ ਆ ਇੱਥੇ ਸੀਗਾ ਟਰੈਫਿਕ ਡੀ ਸੀ ਚੌਂਕ ਲਾਗੇ ਕਾਫੀ ਉੱਥੇ ਪੁਲਿਸ ਵਗੈਰਾ ਆ ਹਾਂਜੀ ਹਾਂਜੀ ਹਾਂਜੀ

ਸਰ ਮੈਂ ਟਰੈਫਿਕ ਦੇ ਵਿੱਚ ਹੀ ਫਸਿਆ ਹੋਇਆ ਉੱਥੇ ਕਾਫੀ ਸਾਰੀ ਗੱਡੀਆਂ ਵਗੈਰਾ ਜੈਮ ਲੱਗਿਆ ਹੋਇਆ ਵਾ ਹਾਂਜੀ ਸਰ ਉਹੀ ਆ ਇਹਨਾਂ ਨੇ ਮਤਲਬ ਜਿੱਦਾਂ ਟਰੈਫਿਕ ਦੇ ਵਿੱਚ ਉੱਧਰ ਹਾਂਜੀ ਸਰ ਉਹ ਮੈਂ ਪਿੱਛੋਂ ਜਾ ਹੀ ਨਹੀਂ ਸਕਦਾ ਉਹਨਾਂ ਨੇ ਮਤਲਬ ਸਿੰਪਲ ਹੀ ਲੈਨ ਜੀ ਬਣਾ ਦਿੱਤੀ ਗੱਡੀਆਂ ਦੀ ਉਹ ਟਰੈਫਿਕ ਦੇ ਵਿੱਚ ਹੁਣ ਸੈਡ ਜਿਹੇ ਤੋਂ ਕੱਢ ਰਹੇ ਆ ਹਾਂਜੀ ਅਤੇ ਮੈਂ ਕੋਸ਼ਿਸ਼ ਕਰਦਾ ਕਿ ਮਤਲਬ ਦੂਸਰਾ ਰੂਟ ਚੇਂਜ ਕਰਾਂ ਅਤੇ ਉਹ ਜਿਹੜੇ ਮਤਲਬ ਜਿਹੜੇ ਟਰੈਫਿਕ ਪੁਲਿਸ ਆ ਉਹ ਥੋੜ੍ਹਾ ਗੱਡੀਆਂ ਨੂੰ ਦੂਸਰੇ ਮਤਲਬ ਰਾਹ ਦੇ ਵਿੱਚ ਭੇਜ ਕੇ ਦੂਸਰਾ ਰੂਟ ਕੱਢ ਰਹੇ ਪਏ ਆ ਹਾਂਜੀ ਫਿਰ ਮੈਂ ਉੱਧਰੋਂ ਕੋਸ਼ਿਸ਼ ਕਰਦਾ ਕਿ ਮਤਲਬ ਆ ਜਾਂਦਾ ਹਾਂਜੀ ਠੀਕ ਹੈ ਸਰ ਮੈਂ ਕੋਸ਼ਿਸ਼ ਕਰਦਾ ਆ ਜਾਂਦਾ ਜੀ ਓਕੇ